ਹਾਂਜੀ ਹਰੇਕ ਕੰਮ ਵਿੱਚ ਮੁਸ਼ਕਿਲਾਂ ਹੁੰਦੀਆਂ ਮੁਸ਼ਕਿਲ ਤੋਂ ਬਿਨਾਂ ਆਈ ਥਿੰਕ ਕੋਈ ਵੀ ਕੰਮ ਨਹੀਂ ਆਪਾਂ ਕਰ ਸਕਦੇ ਤੇ ਮੈਂ ਵੀ ਮੈਨੂੰ ਜਿਵੇਂ ਸੂਟ ਕਲੈਕਟ ਕਰਨ ਦਾ ਬਹੁਤ ਜਿਆਦਾ ਸ਼ੌਂਕ ਹ ਤੇ ਮੈਂ ਆਪਦਾ ਆਨਲਾਈਨ ਬਿਜ਼ਨਸ ਦਾ ਆਫਲਾਈਨ ਬਿਜਨਸ ਵੀ ਕੀਤਾ ਹੋਇਆ ਸੂਟਾਂ ਦਾ ਤੇ ਉਦੋਂ ਮੈਨੂੰ ਕਲੈਕਸ਼ਨ ਦੇ ਰਿਗਾਰਡਿੰਗ ਬਹੁਤ ਜਿਆਦਾ ਮੁਸ਼ਕਿਲਾਂ ਆਈਆਂ ਸੀਗੀਆਂ ਜਿਵੇਂ ਕਿ ਫਸਟ ਮੁਸ਼ਕਿਲ ਦਾ ਮੇਰੀ ਇਹੀ ਸੀ ਵੀ ਮੈਨੂੰ ਸਟੋਰੇਜ ਪ੍ਰੋਬਲਮ ਆਈ ਸੀ ਵੀ ਕਿਉਂਕਿ ਹੁਣ ਜੇ ਸੂਟ ਵੇਚਨੇ ਤੇ ਮੈਨੂੰ ਆਪਦੇ ਕੋਲ ਸੂਟ ਰੱਖਣੇ ਵੀ ਪੈਣੇ ਆ ਤੇ ਉਹ ਸੂਟ ਰੱਖਣ ਲਈ ਮੇਰੇ ਕੋਲ ਜਗਹਾ ਇਨੀ ਜਿਆਦਾ ਨਹੀਂ ਸੀਗੀ ਘੱਟ ਸੀ ਜਗਹਾ ਜਿਹਦੇ ਕਰਕੇ ਨਾ ਉਹ ਸਾਰਾ ਘਪਲਾ ਜਿਹਾ ਹੋਇਆ ਰਹਿੰਦਾ ਸੀ ਵੀ ਮਿਕਸ ਅਪ ਜਿਹਾ ਹੋ ਜਾਂਦਾ ਸੀ ਕੁਝ ਪਤਾ ਨਹੀਂ ਲੱਗਦਾ ਸੀ ਇੱਕ ਤਾਂ ਉਹਨੂੰ ਮੈਨੇਜ ਕਰਨਾ ਬਹੁਤ ਔਖਾ ਸੀ ਉਹਦੇ ਨਾਲ ਮੇਰੀ ਕੋਸਟ ਵੀ ਵੱਧ ਗਈ ਕਿਉਂਕਿ ਉਹਨੂੰ ਮੈਨੇਜ ਕਰਨ ਲਈ ਬੰਦੇ ਰੱਖਣੇ ਪੈਂਦੇ ਸੀ ਤੇ ਕਈ ਵਾਰੀ ਆਪਾਂ ਆਪ ਹੀ ਕਨਫਿਊਜ਼ ਹੋ ਜਾਂਦੇ ਸੀ ਵੀ ਕਿਹੜੀ ਚੀਜ਼ ਕਿੱਥੇ ਪਈ ਹੈ ਕਿਉਂਕਿ ਜਗਾ ਘੱਟ ਸੀ ਤਾਂ ਸਾਰਾ ਕੁਝ ਇੱਕ ਦੂਜੇ ਦੇ ਉੱਤੇ ਹੀ ਪਿਆ ਰਹਿ ਜਾਂਦਾ ਸੀ ਪਹਿਲੀ ਤਾਂ ਪ੍ਰੋਬਲਮ ਇਹੀ ਸੀ ਦੂਜੀ ਕੋਸਟ ਪ੍ਰੋਬਲਮ ਹੋ ਗਈ ਤੀਜੀ ਪ੍ਰੋਬਲਮ ਮੇਨ ਹੈ ਕਿ ਟਿੱਡੀਆਂ ਦਾ ਡਰ ਚੂਹਿਆਂ ਦਾ ਡਰ ਕਿਉਂਕਿ ਹੁਣ ਜੇ ਕੱਪੜੇ ਦਾ ਬਿਜ਼ਨਸ ਕੀਤਾ ਤਾਂ ਓਬੀਅਸਲੀ ਗੱਲ ਹੈ ਵੀ ਕੱਪੜਾ ਇਕੱਲਾ ਆਪਾਂ ਇੱਕ ਟਾਈਪ ਦਾ ਹੀ ਨਹੀਂ ਰੱਖਾਂਗੇ ਇਕੱਲੇ ਕਾਟਨ ਦਾ ਹੀ ਨਹੀਂ ਰੱਖਾਂਗੇ ਵੀ ਆਪਾਂ ਉਸ ਕੱਪੜਾ ਹਰੇਕ ਟਾਈਪ ਦਾ ਰੱਖਾਂਗੇ ਜਿਵੇਂ ਸਿਲਕੈ ਐ ਮੇਨ ਆਪਾਂ ਸਿਲਕ ਦੇ ਕੱਪੜੇ ਰੱਖਾਂਗੇ ਵਿਆਹ ਸ਼ਾਦੀਆਂ ਵਿੱਚ ਕੰਮ ਹੁੰਦੇ ਆ ਤੇ ਉਹ ਸਿਲਕ ਦੇ ਕੱਪੜੇ ਨੂੰ ਮੇਨ ਡਰ ਹੁੰਦਾ ਵੀ ਉਹ ਟਿੱਡੀ ਬਾਹਲੀ ਲੱਗਦੀ ਆ ਉਹਦੇ ਤੇ ਉਹ ਟਿੱਡੀਆਂ ਵੀ ਲੱਗ ਜਾਂਦੀਆਂ ਜਿਹਦੇ ਕਰਕੇ ਕਈ ਵਾਰੀ ਮੇਰਾ ਨੁਕਸਾਨ ਵੀ ਹੋਇਆ ਟਿੱਡੀਆਂ ਲੱਗਣ ਕਰਕੇ ਤਾਂ ਉਸ ਚੀਜ਼ ਨੂੰ ਹੈਂਡਲ ਕਰਨ ਦੇ ਲਈ ਦਵਾਈਆਂ ਛਿੜਕਦੀਆਂ ਜਾਂ ਕੋਈ ਵੀ ਹੋਰ ਉਪਾਅ ਕਰਨੇ ਇਹ ਵੀ ਇੱਕ ਬਹੁਤ ਜਿਆਦਾ ਮੁਸ਼ਕਿਲ ਸੀ ਬਟ ਮੈਂ ਆਪਦਾ ਕੰਮ ਪੂਰੀ ਲਗਨ ਦੇ ਨਾਲ ਕੀਤਾ ਨੋ ਡਾਊਟ ਹਰ ਇੱਕ ਚੀਜ਼ ਵਿੱਚ ਮੁਸ਼ਕਿਲ ਆਉਂਦੀ ਹੀ ਆਉਂਦੀ ਹੈ